ਇੱਕ ਖੂਹ ਵਿੱਚੋਂ ਪਾਣੀ ਕੱਢਣ ਵਾਸਤੇ ਕਈ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਹੁੰਦੀਆਂ ਹਨ ਪਹਿਲੇ ਨੰਬਰ 'ਤੇ ਇਹਨੂੰ ਮੈਨੂਅਲੀ ਹੱਥ ਨਾਲ ਕੱਢਿਆ ਜਾ ਸਕਦਾ ਜਿਵੇਂ ਕਿ ਬਾਲਟੀ ਅਤੇ ਰੱਸੇ ਦੀ ਮਦਦ ਨਾਲ ਅਤੇ ਦੂਸਰੇ ਨੰਬਰ 'ਤੇ ਜੋ ਪਹਿਲੇ ਸਮੇਂ ਦੇ ਵਿੱਚ ਬਲਦਾਂ ਦੇ ਨਾਲ ਉੱਪਰ ਹਲਟੀ ਲਗਾ ਕੇ ਬਲਦਾਂ ਨੂੰ ਜੋੜ ਕੇ ਪਾਣੀ ਕੱਢਿਆ ਜਾਂਦਾ ਸੀ ਉਹ ਪਾਣੀ ਨੂੰ ਪੀਤਾ ਜਾਂਦਾ ਜਾਂਦਾ ਸੀ ਨਹਾਇਆ ਜਾਂਦਾ ਸੀ ਅਤੇ ਖੇਤਾਂ ਦੀ ਸਿੰਚਾਈ ਕੀਤੀ ਜਾਂਦੀ ਸੀ ਅਤੇ ਅੱਜ ਦੇ ਸਮੇਂ ਦੇ ਵਿੱਚ ਖੂਹ 'ਚੋਂ ਪਾਣੀ ਕੱਢਣ ਲਈ ਜੋ ਕਿ ਆਮ ਜਿਹੀ ਗੱਲ ਹੈ ਕਿ ਇਲੈਕਟਰੀਕਲ ਮੋਟਰ ਲਗਾਈ ਜਾਂਦੀ ਹੈ ਜਿਸ ਦੀ ਇੱਕ ਪਾਇਪ ਪਾਣੀ ਦੇ ਵਿੱਚ ਫਿਟ ਕੀਤੀ ਜਾਂਦੀ ਹੈ ਅਤੇ ਦੂਸਰੀ ਪਾਈਪ ਆਊਟਲੈਟ ਬਾਹਰ ਕੱਢੀ ਜਾਂਦੀ ਹੈ ਅਤੇ ਉਹਨੂੰ ਕਨੈਕਸ਼ਨ ਦੇ ਕੇ ਉਹਦੇ ਥਰੂ ਪਾਣੀ ਕੱਢਿਆ ਜਾ ਸਕਦਾ ਹੈ ਪਾਣੀ ਸਟੋਰ ਕੀਤਾ ਜਾ ਸਕਦਾ ਹੈ ਅਤੇ ਇਹਨੂੰ ਪੀਣ ਲਈ ਨਹਾਉਣ ਲਈ ਜਾਂ ਬਰਤਨ ਭਾਂਡੇ ਧੋਣ ਲਈ ਵਰਤਿਆ ਜਾ ਸਕਦਾ ਹੈ ਅਤੇ ਅੱਜ ਕੱਲ੍ਹ ਇਹੀ ਚੀਜ਼ ਪ੍ਰਚੱਲਿਤ ਹੈ ਪਹਿਲਾ ਸਿਸਟਮ ਤਾਂ ਬੰਦ ਹੋ ਗਿਆ ਹੁਣ ਇਲੈਕਟ੍ਰੀਕਲ ਮੋਟਰ ਨਾਲ ਹੀ ਜ਼ਿਆਦਾਤਰ ਲੋਕ ਖੂਹਾਂ 'ਚੋਂ ਪਾਣੀ ਕੱਢਦੇ ਹਨ ਜਾਂ ਸਿੰਚਾਈ ਕਰਦੇ ਹਨ ਖੇਤੀ ਕਰਦੇ ਹਨ ਆਪਣੀ ਫਸਲ ਪਾਲਦੇ ਹਨ ਉਹ ਇਲੈਕਟਰੀਕਲ ਮੋਟਰ ਨਾਲ ਹੀ ਕਰਦੇ ਹਨ ਅਤੇ ਘਰਾਂ ਦੇ ਵਿੱਚ ਵੀ ਇਹ ਸਿਸਟਮ ਹੀ ਲਾਗੂ ਹੈ ਜਿਸ ਏਰੀਏ ਦੇ ਵਿੱਚ ਖੂਹ ਹਨ ਉਹਨਾਂ ਨੂੰ ਪਾਣੀ ਕੱਢਣ ਲਈ ਇਲੈਕਟ੍ਰੀਕਲ ਮੋਟਰਾਂ ਦਾ ਹੀ ਇਸਤੇਮਾਲ ਕੀਤਾ ਜਾਂਦਾ ਹੈ ਜੋ ਕਿ ਇੱਕ ਬੜਾ ਹੀ ਸਸਤਾ ਸਿੰਪਲ ਅਤੇ ਅਸਾਨ ਤਰੀਕਾ ਹੈ ਇਹ ਕਰਨ ਵਾਸਤੇ ਸਾਨੂੰ ਇੱਕ ਪਾਈਪ ਹੈ ਜਿਹੜੀ ਇਨਲੈਟ ਪਾਣੀ ਦੇ ਵਿੱਚ ਐਂਟਰ ਕਰਨੀ ਪੈਂਦੀ ਹੈ ਜਿਹੜਾ ਆਊਟਲੈਟ ਹੈ ਉਹ ਪਾਣੀ ਤੋਂ ਬਾਹਰ ਜ਼ਮੀਨ ਵਾਲੇ ਪਾਸੇ ਨੂੰ ਜਾਂ ਜਿਸ ਜਗ੍ਹਾ 'ਤੇ ਸਟੋਰ ਕਰਨਾ ਹੈ ਪਾਣੀ ਉੱਥੇ ਪਾਈ ਜਾਂਦੀ ਹੈ ਅਤੇ ਇਲੈਕਟ੍ਰੀਕਲ ਕਨੈਕਸ਼ਨ ਦੇ ਕੇ ਉਹਨੂੰ ਓਨ ਕੀਤਾ ਜਾਂਦਾ ਠੀਕ ਹੈ ਜੀ